ਹਾਂ ਮੈਂ ਮੱਧ ਪੀੜ੍ਹੀ ਦਾ ਹਿੱਸਾ ਕਿਉਂਕਿ ਮੇਰੀ ਪੀੜ੍ਹੀ ਉਹ ਪੀੜ੍ਹੀ ਹੈ ਜਿਹਨੇ ਪੰਜਾਬ ਦਾ ਪੁਰਾਣਾ ਸੱਭਿਆਚਾਰ ਵੀ ਆਨੰਦ ਮਾਣਿਆ ਅਤੇ ਉਹ ਪੀੜ੍ਹੀ ਹੈ ਜਿਸ ਨੇ ਅੱਜ ਕੱਲ੍ਹ ਦੇ ਆਧੁਨਿਕ ਜਿਹੜੇ ਬੱਚੇ ਨੇ ਉਹਨਾਂ ਦੀ ਜ਼ਿੰਦਗੀ ਨੂੰ ਵੀ ਮਾਣਿਆ ਇਸ ਕਰਕੇ ਮੈਨੂੰ ਉਹ ਪੁਰਾਣੀ ਸੱਭਿਆਚਾਰ ਅਤੇ ਨਵੇਂ ਜਿਹੜੇ ਆਧੁਨਿਕ ਸੱਭਿਆਚਾਰ ਹੈ ਯਾ ਆਧੁਨਿਕ ਰੋਹ ਰੀਤਾਂ ਨੇ ਮੈਨੂੰ ਦੋਵੇਂ ਹੀ ਪਸੰਦ ਨੇ ਕਿਉਂਕਿ ਇਹ ਸਮੇਂ ਦੀ ਲੋੜ ਹੈ